ਅੱਜ ਕੱਲ੍ਹ ਦੇ ਬੱਚੇ ਸਕਰੀਨਾਂ 'ਤੇ ਜ਼ਿਆਦਾ ਗੇਮਾਂ ਖੇਡਦੇ ਹਨ ਜਿੱਦਾਂ ਕਿ ਵੀਡੀਓ ਗੇਮਾਂ ਵੱਲ ਧਿਆਨ ਜ਼ਿਆਦਾ ਹੈ ਰੁਝਾਨ ਜ਼ਿਆਦਾ ਹੈ ਪਰ ਇਸ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਝੇਲਣਾ ਪੈ ਸਕਦਾ ਜਿੱਦਾਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ 'ਤੇ ਅਸਰ ਪੈ ਸਕਦਾ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰਨ ਲਈ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਉਹਨਾਂ ਨਾਲ ਆਪ ਵੀ ਫਿਜੀਕਲ ਐਕਸਰਸਾਈਜ਼ ਵਾਲੀ ਗੇਮ ਖੇਡਣੀ ਚਾਹੀਦੀ ਹੈ ਤਾਂ ਕਿ ਉਹ ਇਹਨਾਂ ਵੱਲ ਜ਼ਿਆਦਾ ਰੁਝਾਨ ਪੇਸ਼ ਕਰਨ ਜਿੱਦਾਂ ਕਿ ਕ੍ਰਿਕਟ ਗੇਮ ਅਸੀਂ ਵੀ ਉਹਨਾਂ ਨਾਲ ਖੇਡੀਏ ਤਾਂ ਕਿ ਉਹ ਵੀ ਕਹਿਣ ਕਿ ਸਾਡੇ ਨਾਲ ਵੱਡੇ ਖੇਡ ਰਹੇ ਹਨ ਅਤੇ ਅਸੀਂ ਵੀ ਖੇਡੀਏ ਕਿਉਂਕਿ ਮੋਬਾਈਲਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਮੋਬਾਈਲ ਦੀ ਟੈਂਸ਼ਨ ਦਿਮਾਗ 'ਤੇ ਪੈਣੀ ਸ਼ੁਰੂ ਹੋ ਜਾਂਦੀ ਹੈ ਆਉਣ ਵਾਲੇ ਟੈਮ 'ਚ ਕਿਉਂਕਿ ਬਾਹਰਲੇ ਮੁਲਕਾਂ 'ਚ ਮੋਬਾਇਲ ਰਿਡੀਡਿਕਸ਼ਨ ਸੈਂਟਰ ਵੀ ਖੁੱਲ੍ਹ ਗਏ ਹਨ ਅਤੇ ਕੱਲ੍ਹ ਨੂੰ ਆਉਣ ਵਾਲੇ ਟਾਈਮ 'ਚ ਹਿੰਦੁਸਤਾਨ ਦੇ ਵਿੱਚ ਵੀ ਇਹ ਇਹ ਅ ਸ਼ੁਰੂ ਹੋ ਸਕਦਾ ਹੈ ਅਸੀਂ ਇਸ ਚੀਜ਼ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਕਿ ਉਹ ਆਪਣੀ ਵਰਜਿਸ਼ ਵੱਲ ਧਿਆਨ ਦੇਣ ਧੰਨਵਾਦ ਜੀ